ਇੱਕ ਫੋਟੋਗ੍ਰਾ ਜੋ ਕਿ ਮੈਂ ਲਿਆ ਸੀਗਾ ਉਹ ਸੀਗਾ ਇੱਕ ਪਰਿਵਾਰ ਦੀ ਤਸਵੀਰ ਸੀ ਉਹਦੇ ਵਿੱਚ ਉਹ ਬਹੁਤ ਹੀ ਸੋਹਣਾ ਸੀਗਾ ਅਤੇ ਮੇਰਾ ਬਹੁਤ ਹੀ ਮਨਪਸੰਦ ਦਾ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਵੈਸੇ ਤਾਂ ਇੱਕ ਵਧੀਆ ਫੋਟੋਗ੍ਰਾ ਉਹੀ ਹੁੰਦਾ ਹੈ ਜਿਹਦੇ ਵਿੱਚ ਜੋ ਉਹ ਬਣਾ ਰਿਹਾ ਹੈ ਉਹ ਦੇਖ ਕੇ ਹੀ ਉਹਦੇ ਵਿੱਚ ਜੋ ਉਹਦੀਆਂ ਫੀਲਿੰਗ ਜਾਂ ਜੋ ਇਮੋਸ਼ਨਜ ਉਹ ਪਾਉਣਾ ਚਾਹੁੰਦਾ ਉਹ ਦੇਖ ਕੇ ਹੀ ਸਮਝ ਆਵੇ ਅਤੇ ਉਹ ਨੇ ਜੋ ਤਸਵੀਰ ਬਣਾਈ ਸੀਗੀ ਅਤੇ ਉਹ ਜੋ ਉਹ ਕਹਿਣਾ ਚਾਹੁੰਦਾ ਸੀਗਾ ਉਹ ਬਹੁਤ ਹੀ ਵਧੀਆ ਜਿਹੜਾ ਸੀਗਾ ਉਹਦੇ ਵਿੱਚ ਦਿਖ ਰਿਹਾ ਸੀਗਾ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਆ ਵਧੀਆ ਵਧੀਆ ਇਕੱਠੇ ਖੁਸ਼ ਰਹਿੰਦੇ ਆ ਆਪਸ ਦੇ ਵਿੱਚ ਮਿਲ ਕੇ ਰਹਿੰਦੇ ਆ ਜਦੋਂ ਉਹ ਥੋੜ੍ਹੇ ਜਿਹੇ ਵੀ ਅਲੱਗ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਆਪਸ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ ਹੈ ਅਤੇ ਫਿਰ ਕੀ ਹੁੰਦਾ ਹੈ ਕਿ ਕੋਈ ਵੀ ਖੁਸ਼ ਨਹੀਂ ਰਹਿ ਪਾਉਂਦਾ ਪਰ ਉਹ ਤਸਵੀਰ ਦੇ ਵਿੱਚ ਕੀ ਸੀਗਾ ਕਿ ਆਪਸ ਦੇ ਵਿੱਚ ਇੱਕ ਰਲ ਮਿਲ ਕੇ ਕਿੱਦਾਂ ਰਹਿਣਾ ਹੈ ਜਾਂ ਏਕਤਾ ਕਿੱਦਾਂ ਰੱਖਣੀ ਆ ਉਹ ਸਭ ਜਿਹੜਾ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਸੀਗਾ ਸੋ ਇਸ ਕਰਕੇ ਜਿਹੜੀ ਫੋਟੋਗ੍ਰਾ ਵਾ ਜੋ ਮੈਂ ਲਈ ਸੀਗੀ ਇਹ ਸਭ ਤੋਂ ਮੇਰੀ ਮਨਪਸੰਦ ਦੀ ਫੋਟੋ ਆ